ਅਸੀਂ ਆਪਣੇ ਪੌਦਿਆਂ ਦੀ ਸਿਹਤ ਲਈ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਤੋਂ ਔਨਲਾਈਨ ਵੀ ਰਾਏ ਲੈ ਲੈਂਦੇ ਹਾਂ ਅਤੇ ਜੋ ਕਿ ਸਾਡੇ ਬਜ਼ੁਰਗਾਂ ਨੂੰ ਵੀ ਇਸ ਕਿੱਤੇ ਬਾਰੇ ਬਹੁਤ ਪਤਾ ਹੈ ਕਿਉਂਕਿ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਜੁੜੇ ਨੇ ਜੋ ਕਿ ਸਮੇਂ ਸਮੇਂ 'ਤੇ ਸਾਨੂੰ ਦੱਸਦੇ ਰਹਿੰਦੇ ਨੇ ਵੀ ਇਸ ਨੂੰ ਹੁਣ ਪਾਣੀ ਦੀ ਲੋੜ ਹੈ ਇਸ ਨੂੰ ਰੇਹ ਦੀ ਲੋੜ ਹੈ ਇਸਨੂੰ ਹੁਣ ਸਪਰੇ ਦੀ ਲੋੜ ਹੈ ਜੇ ਕੋਈ ਮੱਛਰ ਪੈ ਜਾਂਦਾ ਤਾਂ ਸਪਰੇ ਕਰਨੀ ਪੈਂਦੀ ਹੈ ਸਮੇਂ ਸਮੇਂ 'ਤੇ ਸਾਨੂੰ ਅਲਰਟ ਕਰਦੇ ਰਹਿੰਦੇ ਨੇ ਘਰ ਵਿੱਚ ਅਸੀਂ ਖੇਤ ਵਿੱਚ ਨਿੰਬੂ ਦਾ ਅਨਾਰਾਂ ਦਾ ਪੌਦੇ ਜਾਮਣਾਂ ਅਮਰੂਦ ਬਾਗਬਾਨੀ ਲਾ ਕੇ ਰੈ ਰੱਖਦੇ ਹਾਂ ਜੋ ਕਿ ਸਾਨੂੰ ਔਨਲਾਈਨ ਵੀ ਯੂਨੀਵਰਸਿਟੀਆਂ ਤੋਂ ਇਸ ਚੀਜ਼ ਬਾਰੇ ਪਤਾ ਲੱਗਦਾ ਰਹਿੰਦਾ ਹੈ ਵੀ ਕੋਈ ਵੀ ਇਸ ਨੂੰ ਬਿਮਾਰੀ ਆਉਂਦੀ ਹੈ ਤਾਂ ਅਸੀਂ ਪੌਦੇ ਨੂੰ ਸਕੈਨ ਕਰਕੇ ਯੂਨੀਵਰਸਿਟੀ ਤੋਂ ਪਤਾ ਲੈ ਸਕਦੇ ਹਾਂ ਵੀ ਇਸ 'ਤੇ ਕਿਸ ਤਰ੍ਹਾਂ ਦੀ ਸਪਰੇ ਕਰਨੀ ਹੈ ਯੂਨੀਵਰਸਿਟੀ ਸਾਨੂੰ ਬਹੁਤ ਹੀ ਸਹਾਇਤਾ ਕਰਦੀ ਹੈ ਯੂਨੀਵਰਸਿਟੀ ਵਿੱਚ ਬਹੁਤ ਤਰ੍ਹਾਂ ਦੇ ਪੌਦੇ ਮਿਲਦੇ ਹਨ ਜੋ ਕਿ ਸਾਨੂੰ ਬਹੁਤ ਵਧੀਆ ਸਾਨੂੰ ਬਹੁਤ ਹੀ ਲਾਭਦਾਇਕ ਹੁੰਦੀ ਹੈ ਯੂਨੀਵਰਸਿਟੀਆਂ ਤੋਂ ਰੇਹਾਂ ਸਪਰੇਹਾਂ ਵੀ ਸਾਨੂੰ ਸਸਤੀਆਂ ਮਿਲ ਜਾਂਦੀਆਂ ਹਨ ਪੰਜਾਬ ਗੌਰਮੈਂਟ ਨੇ ਵੀ ਇਸ ਚੀਜ਼ ਵਾਸਤੇ ਬਹੁਤ ਛੋਟ ਦਿੱਤੀ ਹੈ ਕੋਈ ਬਾਗਬਾਨੀ ਕਰਨੀ ਹੈ ਤਾਂ ਆਪਾਂ ਨੂੰ ਵਧੀਆ ਸਹੂਲਤ ਦਿੱਤੀ ਜਾਂਦੀ ਹੈ ਪੌਦੇ ਸਾਡੇ ਬਹੁਤ ਹੀ ਅ ਆਲੇ ਦੁਆਲੇ ਨੂੰ ਸਾਫ ਸੁਥਰਾ ਸਾਹ ਸਾਨੂੰ ਸਾਹ ਲੈਣ ਆਕਸੀਜਨ ਮਿਲਦੀ ਹੈ ਪੌਦੇ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਹੈ ਧੰਨਵਾਦ